ਬਿਮਾਰੀਆਂ ਤੋਂ ਬਚਣ ਲਈ ਅਤੇ ਸਿਹਤਮੰਦ ਰਹਿਣ ਲਈ ਸਭ ਤੋਂ ਸਟੀਕ ਪੁਆਇੰਟ ਇਹ ਹੈ ਕਿ ਬਾਹਰ ਦਾ ਖਾਣਾ ਬੰਦ ਕਰਨਾ ਚਾਹੀਦਾ ਹੈ ਅਤੇ ਹਰੀਆਂ ਭਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ਅਤੇ ਦੂਜਾ ਕਸਰਤ ਹਰ ਰੋਜ਼ ਹੀ ਕਰਨੀ ਚਾਹੀਦੀ ਹੈ ਅਤੇ ਸਵੇਰ ਦੀ ਸੈਰ ਸਭ ਤੋਂ ਲਾਭਦਾਇਕ ਹੁੰਦੀ ਹੈ ਇਹੀ ਸਭ ਚੀਜ਼ਾਂ ਹੈ ਜੋ ਆਪਾਂ ਨੂੰ ਸਿਹਤਮੰਦ ਰੱਖ ਸਕਦੀਆਂ ਹਨ